ਪੰਜਾਬੀ ਸੱਭਿਆਚਾਰ ਕਿਆ ਹਾਸੋਹੀਣੀ ਗੱਲ ਕੀਤੀ ਹੈ ਪੰਜਾਬੀ ਸੱਭਿਆਚਾਰ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਇਹ ਜਿਹੜਾ ਸੱਭਿਆਚਾਰ ਹੈ ਇਹ ਦਿਲ ਤੋਂ ਦਿਮਾਗ ਤੋਂ ਸਾਰੀਆਂ ਇੱਕੋ ਹੀ ਇਹਦੀ ਰਵਾਇਤ ਹੈ ਇੱਕੋ ਹੀ ਇਹਦਾ ਸਨਮਾਨ ਹੈ ਇੱਕੋ ਹੀ ਇਹਦਾ ਸੱਭਿਆਚਾਰ ਹੈ ਉਹਦਾ ਸੱਭਿਆਚਾਰ ਅਸੀਂ ਜਿਹੜਾ ਛੋਟੇ ਜਿਹੇ ਲਫਜ਼ਾਂ ਵਿੱਚ ਬੋਲੀਏ ਉਹਨੂੰ ਕਹਿੰਦੇ ਹੈ ਮਿਲ ਵਰਤ ਕੇ ਪਿਆਰ ਨਾਲ ਇੱਕ ਦੂਜੇ ਨਾਲ਼ ਮਿਲ ਜੁਲ ਕੇ ਰਹਿਣਾ